ਸੋਨ ਟੂਰ ਐਂਡ ਟਰੈਵਲ ਤੋਂ ਗੱਲ ਕਰ ਰਹੇ ਹੋ ਜੀ ਸੋਨੂ ਜੀ ਤੋਂ ਨੰਬਰ ਮਿਲਿਆ ਸੀਗਾ ਜੀ ਤੁਹਾਡਾ ਸਾਡਾ ਇੱਕ ਟੂਰ ਸੀਗਾ ਜੀ ਅਸੀਂ ਮਾਨਸਾ ਤੋਂ ਮੋਹਾਲੀ ਜਾਣਾ ਸੀਗਾ ਅਤੇ ਦੋ ਦਿਨ ਦਾ ਸਾਡਾ ਟੂਰ ਹੈ ਜੀ ਅਤੇ ਤੁਹਾਡੇ ਜਾਂ ਉਹਦਾ ਦੱਸੋ ਜੀ ਕਿ ਪੈਕੇਜ ਕੀ ਹੈ ਜਾਂ ਕਿਲੋਮੀਟਰ ਦੇ ਅਕੋਰਡਿੰਗ ਚੱਲਦੇ ਹੋ ਜਾਂ ਲੰਮ ਸਮ ਹੈ ਜਾਂ ਫਿਕਸ ਹੈ ਕਿਸ ਤਰ੍ਹਾਂ ਹੈਗਾ ਜੀ ਤੁਹਾਡਾ ਹਿਸਾਬ ਕਿਤਾਬ ਅਤੇ ਉਹਦੇ ਵਿੱਚ ਇਹ ਸੀ ਇੱਕ ਤਾਂ ਅਸੀਂ ਚਾਰ ਮੈਂਬਰ ਹੈਗੇ ਹਾਂ ਉਹਨਾਂ ਨੇ ਜਾਣਾ ਹੈ ਜੀ ਦੂਜਾ ਅਸੀਂ ਛੇ ਮੈਂਬਰ ਹੈ ਜੀ ਉਹਨਾਂ ਨੇ ਜਾਣਾ ਹੈ ਇਹਦੇ ਵਿੱਚ ਤੁਸੀਂ ਸਾਨੂੰ ਦੱਸੋ ਵੀ ਤੁਹਾਡੇ ਜਿਹੜੇ ਰੇਟ ਹੈਗੇ ਹੈ ਉਹ ਕਿਲੋਮੀਟਰ ਦੇ ਹਿਸਾ ਅਕੋਰਡਿੰਗ ਲਉਂਗੇ ਸਾਡੇ ਤੋਂ ਜਾਂ ਫਿਕਸ ਲਉਂਗੇ ਇੱਕ ਸਾਨੂੰ ਇਹ ਦੱਸੋ ਵੀ ਜੇ ਅਸੀਂ ਸਾਡਾ ਟੂਰ ਦੋ ਦਿਨ ਦਾ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜਾ ਤੁਹਾਡਾ ਡਰਾਈਵਰ ਹੈ ਜਾਂ ਤੁਹਾਡੀ ਤਰਫੋਂ ਉਹਦੇ ਕੀ ਫਿਕਸ ਚਾਰਜਸ ਹੈਗੇ ਹੈ ਅਤੇ ਜਿਹਦੇ ਰਿਗਾਰਡਿੰਗ ਸਾਨੂੰ ਉੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੋਂ ਇਲਾਵਾ ਸਾਨੂੰ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤੁਹਾਡੇ ਡਰਾਈਵਰ ਵਾਲੇ ਪਾਸਿਓਂ ਨਹੀਂ ਆਉਣੀ ਚਾਹੀਦੀ ਜਿਸ ਤਰ੍ਹਾਂ ਕੋਈ ਤੁਹਾਡਾ ਡਰਾਈਵਰ ਕੋਈ ਸਮੋਕਿੰਗ ਕਰਦਾ ਜਾਂ ਡਰਿੰਕਿੰਗ ਕਰਦਾ ਹੈ ਉਸ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਪ੍ਰੇਸ਼ਾਨੀ ਸਾਡੇ ਲਈ ਨਾ ਹੁੰਦੀ ਹੋਵੇ